ਸਾਡੇ ਜ਼ਿਲ੍ਹੇ ਦੇ ਵਿੱਚ ਵਿਆਹ ਦੀ ਰਸਮ ਇਸ ਤਰ੍ਹਾਂ ਹੈ ਵਿਆਹ ਤੋਂ ਦੋ ਦਿਨ ਪਹਿਲਾਂ ਵਿਆਹ ਵਾਲੇ ਘਰ ਗੀਤ ਗਾਏ ਜਾਂਦੇ ਹਨ ਜੋ ਕਿ ਘਰ ਦੀਆਂ ਆਂਢਣਾ ਗੁਆਂਢਣਾਂ ਆ ਕੇ ਘਰ ਦੇ ਵਿੱਚ ਅਲੱਗ ਅਲੱਗ ਕਿਸਮ ਦੇ ਗੀਤ ਗਾਉਂਦੀਆਂ ਹਨ ਉਸ ਤੋਂ ਬਾਅਦ 'ਚ ਦੋ ਦਿਨ ਪਹਿਲਾਂ ਘਰ ਦੇ ਵਿੱਚ ਜਿਸ ਲੜਕੇ ਜਾਂ ਲੜਕੀ ਦਾ ਵਿਆਹ ਹੁੰਦਾ ਹੈ ਤਾਂ ਉਸਦੇ ਵੱਟਣਾ ਮਲਿਆ ਜਾਂਦਾ ਹੈ ਔਰ ਵਿਆਹ ਵਾਲੇ ਦਿਨ ਸ਼ਾਮ ਨੂੰ ਮੜ੍ਹਾ ਬੰਨਿਆ ਜਾਂਦਾ ਹੈ ਉਸ ਤੋਂ ਬਾਅਦ 'ਚ ਦੂਸਰੇ ਦਿਨ ਬਰਾਤ ਲੜਕੀ ਦੀ ਆਉਂਦੀ ਹੈ ਅਤੇ ਜਾਂ ਲੜਕੇ ਦੀ ਜਾਂਦੀ ਹੈ ਉਸ ਸਮੇਂ ਸਭ ਤੋਂ ਪਹਿਲਾਂ ਜਦੋਂ ਬਰਾਤ ਆਉਂਦੀ ਹੈ ਤਾਂ ਰੀਵਨ ਕਟਾਈ ਕੀਤੀ ਜਾਂਦੀ ਹੈ ਜੋ ਅਹਿਮ ਹੀ ਵਿਆਹ ਦਾ ਹਿੱਸਾ ਮੰਨਿਆ ਜਾਂਦਾ ਹੈ ਉਸ ਤੋਂ ਬਆਦ 'ਚ ਅਨੰਦ ਕਾਰਜਾਂ ਦੀ ਰਸਮ ਹੁੰਦੀ ਹੈ ਜਿਸ ਜਿਸ ਜਾਤੀ ਦੇ ਅਨੰਦ ਕਾਰਜ ਜਾਂ ਜੋ ਹੋਰ ਵੀ ਰਸਮ ਦੇ ਨਾਲ ਉਸੇ ਹਿਸਾਬ ਨਾਲ ਆਪਣੇ ਆਪਣੇ ਕਾਰਜ ਕਰਦੇ ਹਨ ਅਤੇ ਸ਼ਾਮ ਨੂੰ ਲੜਕੀ ਨੂੰ ਵਿਦਾਇਗੀ ਦੇ ਟਾਇਮ ਅਤੇ ਇੱਕ ਬਹੁਤ ਮਾਂ ਪਿਓ ਦਾ ਅਹਿਮ ਰੋਲ ਹੁੰਦਾ ਹੈ ਉਸ ਟਾਇਮ ਲੜਕੀ ਦੇ ਮਾਂ ਬਾਪ ਰਿਸ਼ਤੇਦਾਰ ਸਾਕ ਸਬੰਧੀ ਸਭ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ ਕਿ ਲੜਕੀ ਨੂੰ ਤੋਰਨ ਵੇਲੇ ਇਹ ਰਸਮ ਬਹੁਤ ਹੀ ਜ਼ਿਆਦਾ ਮੰਨੀ ਜਾਂਦੀ ਹੈ